ਮੁੱਢਲੇ ਸਮਿਆਂ ਤੋਂ ਹੀ ਨਾਚ ਕਲਾ ਭਾਰਤੀ ਅਤੇ ਪੰਜਾਬੀ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਰਹੀ ਹੈ ਪਿਛਲੇ ਕੁਝ ਸਮਿਆਂ ਤੋਂ ਪਿੰਡਾਂ ਵਿੱਚ ਵੀ ਨਾਚ ਕਲਾ ਨੂੰ ਬਹੁਤ ਸਤਿਕਾਰ ਮਿਲ ਰਿਹਾ ਹੈ ਸਾਡੇ ਪਿੰਡ ਦੀਆਂ ਮੁਟਿਆਰਾਂ ਅਤੇ ਗੱਭਰੂ ਵੀ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ ਕੁਝ ਬੱਚੇ ਤਾਂ ਯੂਥ ਫੈਸਟੀਵਲ ਰਾਹੀਂ ਜੋਨਲ ਅਤੇ ਅੰਤਰ ਜੋਨਲ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੇ ਕਾਲਜਾਂ ਸਕੂਲਾਂ ਅਤੇ ਪਿੰਡਾਂ ਦਾ ਨਾਂ ਰੌਸ਼ਨ ਕਰਦੇ ਹਨ